ਸੋ ਪੰਜਾਬ ਦੇ ਵਿਆਹਾਂ ਵਿੱਚ ਬਹੁਤ ਸਾਰੇ ਰੀਤੀ ਰਿਵਾਜ਼ ਜਿਹੜੇ ਚੱਲਦੇ ਨੇ ਅਤੇ ਉਹ ਚੋਂ ਕੁਛ ਮੁੱਖ ਰੀਤੀ ਰਿਵਾਜ਼ ਹੈਗੇ ਜਿੱਦਾਂ ਰੋਕਾ ਰੋਕਾ ਕੀ ਹੁੰਦਾ ਹੈ ਕਿ ਪੰਜਾਬ 'ਚ ਜਦੋਂ ਕੁੜੀ ਅਤੇ ਮੁੰਡਾ ਇੱਕ ਦੂਜੇ ਨੂੰ ਪਸੰਦ ਕਰ ਲੈਂਦੇ ਨੇ ਜਾਂ ਕੁੜੀ ਦੇ ਮਾਂ ਪਿਓ ਅਤੇ ਮੁੰਡੇ ਦੇ ਮਾਪਿਆਂ ਵੱਲੋਂ ਹਾਂ ਕਰ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਕੁੜੀ ਨੂੰ ਕੁਝ ਪੈਸੇ ਅਤੇ ਕੁਛ ਡੱਬੇ ਵਗੈਰਾ ਮਿਠਾਈ ਦੇ ਕੇ ਅਤੇ ਉਹਨਾਂ ਨੂੰ ਰੋਕਾ ਦਿੱਤਾ ਜਾਂਦਾ ਜਿਹਦੇ ਨਾਲ ਕੀ ਹੁੰਦਾ ਕਿ ਇਹ ਵਿਆਹ ਪੱਕਾ ਸਮਝਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਵਿਆਹ ਦੀ ਡੇਟ ਫਿਕਸ ਕੀਤੀ ਜਾਂਦੀ ਹੈ ਅਤੇ ਵਿਆਹ ਦੀ ਡੇਟ ਫਿਕਸ ਹੋਣ ਤੋਂ ਬਾਅਦ ਪਹਿਲਾ ਵਿਆਹ ਦਾ ਕਾਰਡ ਜਿਹੜਾ ਹੁੰਦਾ ਹੈ ਉਹ ਕੁੜੀ ਵਾਲੇ ਮੁੰਡੇ ਘਰ ਅਤੇ ਮੁੰਡੇ ਵਾਲੇ ਕੁੜੀ ਘਰ ਭੇਜਦੇ ਨੇ ਉਸ ਤੋਂ ਸ਼ੁਰੂ ਹੁੰਦੀਆਂ ਵਿਆਹ ਦੀਆਂ ਕੁਛ ਮੇਨ ਰਸਮਾਂ ਰਸਮਾਂ ਇਹ ਵੀ ਨੇ ਪਰ ਇਹ ਵੀ ਮੇਨ ਰਸਮਾਂ ਪੰਜਾਬ ਦੀਆਂ ਜਿਹੜੀਆਂ ਚਲਦੀਆਂ ਨੇ ਸਭ ਤੋਂ ਪਹਿਲਾਂ ਕੁੜੀ ਨੂੰ ਉਹਨੂੰ ਹਲਦੀ ਵਗੈਰਾ ਲਗਾਈ ਜਾਂਦੀ ਹੈ ਠੀਕ ਹੈ ਜੀ ਹਲਦੀ 'ਚ ਕੁੜੀ ਨੂੰ ਉਹਦੀਆਂ ਸਹੇਲੀਆਂ ਆਉਂਦੀਆਂ ਨੇ ਅਤੇ ਸਹੇਲੀਆਂ ਹਲਦੀ ਵਗੈਰਾ ਲਗਾਉਂਦੀਆਂ ਨੇ ਅਤੇ ਉਹਨੂੰ ਜਿੱਦਾਂ ਪੁ ਉਹਦਾ ਹਲਦੀ ਵਗੈਰਾ ਲਗਾ ਕੇ ਅਤੇ ਉਹ 'ਚ ਗਾਉਣ ਵਜਾਉਣ ਦਾ ਕੰਮ ਹੁੰਦਾ ਹੈ ਗਾਉਂਦੇ ਨੇ ਸਾਡੇ ਜਿਹੜੇ ਰਵਾਇਤੀ ਗੀਤ ਹੈਗੇ ਨੇ ਸਾਡੀਆਂ ਮੁੰਡੇ ਦਾ ਵਿਆਹ ਹੋਵੇ ਤਾਂ ਘੋੜੀਆਂ ਗਾਈਆਂ ਨੇ ਅਗਰ ਕੁੜੀ ਦਾ ਵਿਆਹ ਹੋਵੇ ਤਾਂ ਸੁਹਾਗ ਜਾ ਗਾਏ ਜਾਂਦੇ ਨੇ ਉਸ ਤੋਂ ਬਾਅਦ ਸਾਡਾ ਆਉਂਦਾ ਹੈ ਰਾਤ ਦਾ ਟਾਈਮ ਗੂਣਾ ਗਾਉਣਾ 'ਚ ਕੀ ਹੁੰਦਾ ਕਿ ਪਿੰਡ ਦੀ ਜੇ ਸਾ ਪਿੰਡ ਦੀਆਂ ਲੇਡੀਜ ਜਾਂ ਆਸ ਪਾਸ ਦੀ ਸ਼ਹਿਰ ਦੀਆਂ ਲੇਡੀਜ ਇਕੱਠੀਆਂ ਹੁੰਦੀਆਂ ਨੇ ਅਤੇ ਰਾਤ ਨੂੰ ਜਿਹੜੇ ਸਾਡੇ ਕੁਛ ਆਪਣੇ ਪੰਜਾਬੀ ਫੋਕ ਜਿਹੜੇ ਸਾਡੇ ਗਾਣੇ ਹੁੰਦੇ ਨੇ ਉਹ ਗਾਏ ਜਾਂਦੇ ਨੇ ਕੁਛ ਹਾਸਾ ਮਜ਼ਾਕ ਕੀਤਾ ਜਾਂਦਾ ਅਤੇ ਕੁਛ ਉਸ ਤੋਂ ਬਾਅਦ ਆਪਣਾ ਜਿਹੜਾ ਕੁਛ ਖਤਮ ਹੋਣ ਤੋਂ ਬਾਅਦ ਸਭ ਨੂੰ ਪਹਿਲਾਂ ਵੰਡੇ ਜਾਂਦੇ ਸੀ ਪਤਾਸੇ ਜਾਂ ਮੂੰਗਫਲੀ ਪਰ ਅੱਜ ਕੱਲ੍ਹ ਦਾ ਜੋ ਸਮਾਂ ਚੱਲ ਰਿਹਾ ਉਹਦੇ ਹਿਸਾਬ ਨਾਲ ਮਿਠਾਈਆਂ ਦਿੱਤੀਆਂ ਜਾਂਦੀਆਂ ਅਤੇ ਜਾਂ ਫਿਰ ਜਿਨ੍ਹਾਂ ਨੇ ਮਤਲਬ ਕੁਛ ਖਾਣਾ ਪੀਣ ਦੇ ਜਿੱਦਾਂ ਸਟਾਲ ਵਗੈਰਾ ਲੱਗੇ ਜਾਂਦੇ ਨੇ ਜਾਂ ਅੱਜ ਕੱਲ੍ਹ ਜੋ ਅੱਜ ਕੱਲ੍ਹ ਐਡਵਾਂਸ ਚੱਲ ਰਿਹਾ ਅੱਜ ਕੱਲ੍ਹ ਡੀ ਜੇ ਲੱਗ ਜਾਂਦੇ ਨੇ ਅਤੇ ਉਹਦੇ ਵਿੱਚ ਹਲਵਾਈ ਵਗੈਰਾ ਲਗਾ ਕੇ ਵੱਖਰੇ ਵੱਖਰੇ ਪਕਵਾਨ ਜਾਂ ਰੋਟੀਆਂ ਸਬਜ਼ੀਆਂ ਬਣਾਈਆਂ ਜਾਂਦੀਆਂ ਹਨ ਅਤੇ ਉਸ ਤੋਂ ਬਾਅਦ ਆਉਂਦਾ ਹੈ ਬਰਾਤ ਵਾਲਾ ਦਿਨ ਬਰਾਤ ਵਾਲੇ ਦਿਨ ਕੀ ਹੁੰਦਾ ਕਿ ਕੁੜੀ ਦੇ ਘਰ ਮੁੰਡਾ ਕੁੜੀ ਦੇ ਮਿੱਥੇ ਸਮੇਂ 'ਤੇ ਮਿੱਥੇ ਹੋਏ ਜਗ੍ਹਾ 'ਤੇ ਆਪਣੀ ਬਰਾਤ ਲੈ ਕੇ ਜਾਂਦਾ ਅਤੇ ਉੱਥੇ ਜਾ ਕੇ ਸਭ ਤੋਂ ਪਹਿਲਾਂ ਮਿਲਨੀਆਂ ਹੁੰਦੀਆਂ ਨੇ ਮਿਲਨੀਆਂ ਕੀ ਹੁੰਦੀਆਂ ਜਿੱਦਾਂ ਕਿ ਆਪਣਾ ਲੜਕੀ ਦਾ ਪਿਓ ਜਾਂ ਕੁੜੀ ਦਾ ਪਿਓ ਅਤੇ ਮੁੰਡੇ ਦਾ ਪਿਓ ਇੱਕ ਦੂਜੇ ਨੂੰ ਹਾਰ ਪਾਉਂਦੇ ਨੇ ਸ਼ਗਨ ਦਿੰਦੇ ਨੇ ਅਤੇ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਰਿਸ਼ਤੇਦਾਰ ਅੱਗੇ ਮਾਮਾ ਚਾਚਾ ਫੁੱਫੜ ਸਾਰੇ ਇਸ ਇਸ ਚੀਜ਼ ਨੂੰ ਉੱਧਰੋਂ ਕੁੜੀ ਦੇ ਮਾਮਾ ਚਾਚਾ ਫੁੱਫੜ ਇੱਧਰੋਂ ਕੁੜੀ ਦੇ ਜਿਹੜੇ ਰਿਸ਼ਤੇਦਾਰ ਹੈਗੇ ਮਾਮਾ ਚਾਚਾ ਫੁੱਫੜ ਜਾਂ ਹੋਰ ਰਿਸ਼ਤੇਦਾਰ ਮਿਲ ਕੇ ਮਿਲਨੀਆਂ ਕਰਦੇ ਨੇ ਇੱਕ ਦੂਜੇ ਨੂੰ ਸ਼ਗਨ ਦਿੰਦੇ ਨੇ ਉਸ ਤੋਂ ਬਾਅਦ ਆਉਂਦਾ ਹੈ ਬਰਾਤ ਦਾ ਵੈਲਕਮ ਹੁੰਦਾ ਹੈ ਜਿਸ 'ਚ ਰਿਮੇਨ ਸਭ ਤੋਂ ਹਾਸੇ ਮਜ਼ਾਕ ਵਾਲੀ ਇੱਕ ਸਾਡੀ ਰਿਵਾਜ਼ ਹੈਗਾ ਰੀਬਨ ਕਟਾਈ ਜਿਹਦੇ 'ਚ ਲੜਕੇ ਦੀਆਂ ਸਾਲੀਆਂ ਜਾਂ ਕੁੜੀਆਂ ਭੈਣਾਂ ਸਹੇਲੀਆਂ ਸਾਰੀਆਂ ਇਕੱਠੀਆਂ ਹੋ ਕੇ ਮੁੰਡੇ ਕੋਲੋਂ ਇੱਕ ਰੀਬਨ ਕਟਾਉਂਦੇ ਨੇ ਉਹਦੇ ਵਿੱਚ ਕੀ ਹੁੰਦਾ ਕਿ ਉਹਨੂੰ ਮੁੰਡੇ ਨਾਲ ਹਾਸਾ ਮਜ਼ਾਕ ਕਰਦੀਆਂ ਮੁੰਡੇ ਵਾਲੇ ਕੁੜੀ ਵਾਲਿਆਂ ਨਾਲ ਹਾਸਾ ਮਜ਼ਾਕ ਕਰਦੇ ਨੇ ਅਤੇ ਰੀਬਨ ਕੱਟਿਆ ਜਾਂਦਾ ਅਤੇ ਰੀਬਨ ਕੱਟਣ ਤੋਂ ਬਾਅਦ ਮੁੰਡਾ ਕੁੜੀ ਵਾਲਿਆਂ ਨੂੰ ਸ਼ਗਨ ਦੇ ਤੌਰ 'ਤੇ ਕੁਛ ਪੈਸੇ ਦਿੰਦਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਆਉਂਦਾ ਜੈਮਾਲਾ ਜੈਮਾਲਾ 'ਚ ਕੀ ਹੁੰਦਾ ਕਿ ਕੁੜੀ ਮੁੰਡੇ ਨੂੰ ਅਤੇ ਮੁੰਡਾ ਕੁੜੀ ਨੂੰ ਇੱਕ ਹਾਰ ਜਿੱਦਾਂ ਵਧੀਆ ਹਾਰ ਬਣਾਏ ਜਾਂਦੇ ਨੇ ਉਹ ਪਾਏ ਪਾਏ ਜਾਂਦੇ ਨੇ ਅਤੇ ਹਾਰ ਪਾਉਣ ਤੋਂ ਬਾਅਦ ਉੱਥੇ ਜਿੱਦਾਂ ਕਿ ਆਪਾਂ ਸਭ ਪੰਜਾਬ ਹੀ ਤੁਹਾਨੂੰ ਪਤਾ ਕਿ ਸਭ ਪੰਜਾਬੀ ਗਾਉਣ ਵਜਾਉਣ ਦੇ ਸ਼ੌਂਕ ਰੱਖਦੇ ਨੇ ਅਤੇ ਉੱਥੇ ਫਿਰ ਡੀ ਜੇ ਵਗੈਰਾ ਲਾ ਕੇ ਪ੍ਰੋਪਰ ਗਾਉਣ ਵਜਾਉਣ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਆਉਂਦੀ ਰਸਮ ਫੇਰਿਆਂ ਦੀ ਜੇ ਤਾਂ ਮੁੰਡਾ ਕੁੜੀ ਸਿੱਖ ਫੈਮਲੀ ਤੋਂ ਬਿਲੋਂਗ ਕਰਦੇ ਨੇ ਅਤੇ ਓ ਉਹ ਗੁਰਦੁਆਰਾ ਸਾਹਿਬ ਜਾ ਕੇ ਫੇਰੇ ਲੈਂਦੇ ਨੇ ਅਗਰ ਉਹ ਹਿੰਦੂ ਤੇ ਫੈਮਲੀ ਤੋਂ ਬਿਲੋਂਗ ਕਰਦੇ ਨੇ ਅਤੇ ਉੱਥੇ ਹੀ ਬੇਦੀ ਦੇ ਫੇਰੇ ਕੀਤੇ ਜਾਂਦੇ ਨੇ ਠੀਕ ਹੈ ਜੀ ਜੇ ਤੁਸੀਂ ਉਹ ਕ੍ਰਿਸਚਨ ਹੁੰਦੇ ਅਤੇ ਕ੍ਰਿਸਚਨ ਆਪਣੇ ਅਕੋਡਿੰਗ ਫੇਰੇ ਲੈਂਦੇ ਨੇ ਅਗਰ ਉਹ ਮੁਸਲਮਾਨ ਹੁੰਦੇ ਨੇ ਅਤੇ ਉਹ ਆਪਣੇ ਅਕੋਰਡਿੰਗ ਜੋ ਵੀ ਉਹਨਾਂ ਦਾ ਕੀਤਾ ਜਾਂਦਾ ਹੈ